ਜੇਕਰ ਦੇਖਿਆ ਜਾਵੇ ਡਾਕਟਰ ਕੋਲ ਪੰਜ ਜਾਣ ਵਾਲੇ ਮਰੀਜ਼ਾਂ ਦੇ ਵਿੱਚੋਂ ਤਿੰਨ ਮਰੀਜ਼ ਤਨਾਵ ਦੇ ਸ਼ਿਕਾਰ ਹੁੰਦੇ ਹਨ ਜਿਸ ਦਾ ਕਾਰਨ ਦੁਨੀਆ ਦਾ ਹੀ ਭੱਜ ਦੌੜ ਹੈ ਅੱਜ ਕੱਲ੍ਹ ਕਿਸੇ ਵੀ ਮਨੁੱਖ ਕੋਲ ਇੰਨਾ ਟੈਮ ਨਹੀਂ ਹੈ ਕਿ ਉਹ ਆਪਣੇ ਮਨੋਰੰਜਨ ਲਈ ਜਾਂ ਉਹ ਆਪਣੇ ਆਨੰਦ ਲਈ ਆਨੰਦ ਲਈ ਟੈਮ ਕੱਢ ਸਕੇ ਜਿਵੇਂ ਕਿ ਪਹਿਲਾਂ ਤਨਾਵ ਦੀ ਸ਼ਿਕਾਇਤ ਬਹੁਤ ਘੱਟ ਹੁੰਦੀ ਸੀ ਇਸ ਦਾ ਕਾਰਨ ਇਹ ਹੀ ਸੀ ਕਿ ਪਹਿਲਾਂ ਲੋਕ ਫੋਨਾਂ ਜਾਂ ਇਲੈਕਟਰੋਨਿਕ ਗੈਜਟਾਂ ਦੇ ਵਿੱਚ ਨਹੀਂ ਉਲਝੇ ਹੋਏ ਸਨ ਅਤੇ ਉਹ ਖੇਡ ਖੇਡਦੇ ਸਨ ਬੱਚੇ ਖੇਡਦੇ ਸਨ ਪਰ ਹੁਣ ਹੁਣ ਜਿਵੇਂ ਬੱਚੇ ਸੁਬਹਾ ਅੱਠ ਵਜੇ ਸਕੂਲ ਭੇਜ ਦਿੱਤੇ ਜਾਂਦੇ ਹਨ ਅਤੇ ਸ਼ਾਮ ਨੂੰ ਛੇ ਵਜੇ ਦੇ ਕਰੀਬ ਘਰ ਪਹੁੰਚਦੇ ਹਨ ਜਿਹਨਾਂ ਕਰਕੇ ਉਹਨਾਂ ਕੋਲ ਖੇਡਣ ਦਾ ਸਮਾਂ ਨਹੀਂ ਹੁੰਦਾ ਅਤੇ ਘਰ ਆ ਕੇ ਵੀ ਉਹ ਸਕੂਲ ਦਾ ਕੰਮ ਵਗੈਰਾ ਕਰਦੇ ਰਹਿੰਦੇ ਹਨ ਜਿਹਨਾਂ ਕਰਕੇ ਉਹ ਤਨਾਵ ਦਾ ਸ਼ਿਕਾਰ ਹੋ ਜਾਂਦੇ ਹਨ ਕਿਉਂਕਿ ਖੇਡਣ ਨਾਲ ਇਕੱਲਾ ਆਪਾਂ ਨੂੰ ਆਨੰਦ ਹੀ ਪ੍ਰਾਪਤ ਨਹੀਂ ਹੁੰਦਾ ਖੇਡਣ ਦੇ ਨਾਲ ਆਪਣੇ ਖੂਨ ਦੀ ਸ਼ਰਕੂਲੇਸ਼ਨ ਜਾਂ ਖੂ ਖੂਨ ਦਾ ਜੋ ਖੂਨ ਦੀ ਸਰਕੂਲੇਸ਼ਨ ਹੁੰਦੀ ਹੈ ਉਹ ਬਹੁਤ ਹੀ ਵਧੀਆ ਹੁੰਦੀ ਹੈ ਜਿਹਦੇ ਕਰਕੇ ਆਪਣਾ ਸਾਰਾ ਤਨਾਵ ਦੂਰ ਹੋ ਜਾਂਦਾ ਹੈ ਅਤੇ ਮਨੁੱਖ ਦੇ ਵਿੱਚ ਹੋਰ ਵੱਧ ਐਨਰਜੀ ਆਉਂਦੀ ਹੈ ਤਾਂ ਕਿ ਉਹ ਆ ਤਾਂ ਕਿ ਉਹ ਕੋਈ ਵੀ ਕੰਮ ਜੋ ਉਹਨੇ ਕਰਨਾ ਹੈ ਉਹ ਕਰ ਸਕੇ ਠੀਕ ਹੈ ਅਤੇ ਖੇਡਾਂ ਸਾਨੂੰ ਇੱਕ ਆਨੰਦ ਪੂਰਨ ਆਊਟਲੈਟ ਦਿੰਦੀਆਂ ਹਨ ਜਿਵੇਂ ਕਿ ਖੇਡਾਂ ਦੇ ਨਾਲ ਖੇਡਣ ਦੇ ਨਾਲ ਆਪਾਂ ਨੂੰ ਬਹੁਤ ਹੀ ਆਨੰਦ ਮਿਲਦਾ ਹੈ ਅਤੇ ਖੇਡਾਂ ਕਿ ਕਿਸੇ ਵੀ ਮਨੁੱਖ ਲਈ ਬਹੁਤ ਹੀ ਜ਼ਿਆਦਾ ਜ਼ਰੂਰੀ ਹਨ ਤਾਂ ਕਿ ਉਹ ਇਸ ਤਨਾਵ ਭਰੀ ਦੁਨੀਆ ਦੇ ਵਿੱਚ ਤਨਾਵ ਰਹਿਤ ਰਹਿ ਸਕੇ ਅਤੇ ਖੇਡਾਂ ਦਾ ਆਨੰਦ ਲੈ ਸਕੇ ਅਤੇ ਉਹ ਖੇਡਾਂ ਤੋਂ ਸਿੱਖ ਲੈ ਸਕੇ ਕਿ ਇੱਕ ਹਾਰ ਨਾਲ ਪੂਰੀ ਜ਼ਿੰਦਗੀ ਜਾਂ ਪੂਰੀ ਜਾਂ ਪੂਰਾ ਜੀਵਨ ਹਾਰ ਨਹੀਂ ਜਾਂਦੇ ਅਤੇ ਸਾਨੂੰ ਹਮੇਸ਼ਾ ਦੂਸਰਾ ਮੌਕਾ ਮਿਲਦਾ ਰਹੂਗਾ